ਵੱਖ ਵੱਖ ਕਿਸਮਾਂ ਦੇ ਜਾਨਵਰ ਆਮ ਤੌਰ 'ਤੇ ਘਰਾਂ ਵਿੱਚ ਵੀ ਪਾਲੇ ਜਾਂਦੇ ਹਨ ਜਿਵੇਂ ਗਊਆਂ ਭੇਡਾਂ ਬੱਕਰੀਆਂ ਮੁਰਗੀਆਂ ਆਦਿ ਸਿਰਫ਼ ਇੱਕ ਕਿਸਮ ਦੇ ਜਾਨਵਰ ਰੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਉਸਦੇ ਖਾਣ ਦਾ ਸਮਾਨ ਇਕੱਠਾ ਕਰਨਾ ਸੌਖਾ ਹੋ ਜਾਂਦਾ ਹੈ ਉਹਨਾਂ ਨੂੰ ਪਾਲਣਾ ਸੌਖਾ ਹੋ ਜਾਂਦਾ ਹੈ ਬਿਮਾਰੀਆਂ ਤੋਂ ਉਹਨਾਂ ਦੀ ਰੱਖਿਆ ਹੋ ਜਾਂਦੀ ਹੈ ਅਤੇ ਘਰ ਵਿੱਚ ਉਹਨਾਂ ਤੋਂ ਪ੍ਰਾਪਤ ਚੀਜ਼ਾਂ ਨੂੰ ਵਰਤ ਵੀ ਲਿਆ ਜਾਂਦਾ ਹੈ ਮੁਰਗੀ ਪਾਲਣ ਆਮ ਤੌਰ 'ਤੇ ਘਰਾਂ ਦੇ ਵਿੱਚ ਆਂਡੇ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ਇਸ ਤੋਂ ਬਿਨ੍ਹਾਂ ਦੁੱਧ ਪ੍ਰਾਪਤ ਕਰਨ ਲਈ ਬੱਕਰੀਆਂ ਗਊਆਂ ਮੱਝਾਂ ਆਦਿ ਵੀ ਪਾਲੀਆਂ ਜਾਂਦੀਆਂ ਹਨ ਰੇਗਿਸਤਾਨੀ ਇਲਾਕਿਆਂ ਵਿੱਚ ਊਠ ਨੂੰ ਹੀ ਪਾਲਿਆ ਜਾਂਦਾ ਹੈ ਭੇਡਾਂ ਤੋਂ ਉੱਨ ਵੀ ਪ੍ਰਾਪਤ ਹੁੰਦੀ ਹੈ ਖਰਗੋਸ਼ਾਂ ਨੂੰ ਵੀ ਪਾਲਿਆ ਜਾਂਦਾ ਹੈ ਖਰਗੋਸ਼ਾਂ ਤੋਂ ਅੰਗੋਰਾਂ ਨਾਮ ਦੀ ਬੜੀ ਕੀਮਤੀ ਉੱਨ ਪ੍ਰਾਪਤ ਹੁੰਦੀ ਹੈ